ਹਾਂਜੀ ਸਾਡੀ ਜਿਹੜੀ ਰੋਜ਼ੀ ਰੋਟੀ ਹੈ ਬਿਜਲੀ 'ਤੇ ਚੱਲਦੀ ਹੈ ਕਿਉਂਕਿ ਸਾਡੇ ਕਿਚਨ ਦੀ ਲਾਈਟ ਬਲ਼ਦੀ ਹੈ ਅਤੇ ਹੋਰ ਪ੍ਰਕਾਰ ਦੀਆਂ ਬਿਜਲੀ ਦੇ ਨਾਲ ਸਾਡੀਆਂ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਅਤੇ ਜਿਹੜੀ ਰੌਸ਼ਨੀ ਹੈ ਸਾਨੂੰ ਬਿਜਲੀ ਰਾਹੀਂ ਮਿਲਦੀ ਹੈ